ਸ਼ੌਕ ਵਜੋਂ ਫੋਟੋਗ੍ਰਾਫੀ ਮੈਂ ਫੋਟੋਗ੍ਰਾਫੀ ਦਾ ਸ਼ੌਕੀਨ ਹਾਂ ਮੈਂ ਇੱਕ ਬਹੁਤ ਹੀ ਵਧੀਆ ਫੋਟੋਗ੍ਰਾਫਰ ਤਾਂ ਨਹੀਂ ਪਰ ਮੈਨੂੰ ਫੋਟੋਆਂ ਖਿੱਚਣਾ ਬਹੁਤ ਪਸੰਦ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਫੋਟੋਆਂ ਵੀਡੀਓ ਵਗੈਰਾ ਬਣਾਉਂਦਾ ਹਾਂ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਮੈਂ ਆਪਣਾ ਪਿਛਲਾ ਸਮਾਂ ਦੇਖ ਸਕਾਂ ਤਾਂ ਜੋ ਉਹਨਾਂ ਨੂੰ ਦੇਖ ਕੇ ਬਹੁਤ ਹੀ ਵਧੀਆ ਖੁਸ਼ ਹਾਲ ਜੀਵਨ ਬਿਤਾ ਸਕਾਂ ਅਤੇ ਫੋਟੋਗ੍ਰਾਫੀ ਮੈਂ ਨੋਰਮਲ ਹਰ ਰੋਜ਼ ਹਰ ਵਕਤ ਕਈ ਵਾਰ ਕਰਦਾ ਰਹਿੰਦਾ ਹਾਂ ਤਾਂ ਜੋ ਆਪਣੇ ਆਪ ਨੂੰ ਸੈਟਸਫਾਈ ਕੀਤਾ ਜਾਵੇ ਆਪਣੇ ਆਪ ਨੂੰ ਦੇਖ ਕੇ ਆਪਣੇ ਆਪ ਨੂੰ ਪੁਰਾਣੇ ਸਮੇਂ ਵਿੱਚ ਦੇਖਣਾ ਇੱਕ ਫੋਟੋਗ੍ਰਾਫੀ ਨਾਲ ਦੇਖਿਆ ਜਾ ਸਕਦਾ ਹੈ ਅੱਜ ਕੱਲ੍ਹ ਫੋਟੋਗ੍ਰਾਫੀਆਂ ਬਹੁਤ ਜ਼ਿਆਦਾ ਹੋ ਰਹੀਆਂ ਹਨ ਲੋਕ ਰੀਲਾਂ ਬਣਾ ਰਹੇ ਹਨ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਵਗੈਰਾ ਵਧੀਆ ਬਣਾ ਰਹੇ ਹਨ ਲੋਕਾਂ ਨੂੰ ਅੱਜ ਕੱਲ੍ਹ ਵੀਡੀਓ ਰੀਲਸ ਬਹੁਤ ਵਧੀਆ ਤਰੀਕੇ ਨਾਲ ਬਣਾਉਣੇ ਚਾਹੀਦੇ ਹਨ ਜਿਵੇਂ ਕਿ ਇੰਸਟਾਗ੍ਰਾਮ ਯੂਟਿਊਬ ਫੇਸਬੁੱਕ ਆਦਿ 'ਤੇ ਅਪਲੋਡ ਕਰਦੀਆਂ ਹੀ ਰਹਿੰਦੀਆਂ ਹਨ ਤਾਂ ਜੋ ਉਹਨਾਂ ਨੂੰ ਦੇਖ ਕੇ ਨੌਜਵਾਨ ਪੀੜ੍ਹੀ ਵਧੀਆ ਬਣ ਸਕੇ ਗਲਤ ਕੰਮਾਂ ਤੋਂ ਦੂਰ ਹੋ ਸਕੇ ਅੱਜ ਕੱਲ੍ਹ ਨੌਜਵਾਨ ਰੀਲਾਂ ਬਹੁਤ ਹੀ ਜ਼ਿਆਦਾ ਗਲਤ ਪਾਉਂਦੇ ਹਨ ਤਾਂ ਜੋ ਉਹਨਾਂ ਦਾ ਮੈਸੇਜ ਛੋਟੇ ਬੱਚਿਆਂ ਬਜ਼ੁਰਗਾਂ 'ਤੇ ਗਲਤ ਪ੍ਰਭਾਵ ਪਾਉਂਦਾ ਹੈ ਇਸ ਲਈ ਫੋਟੋਗ੍ਰਾਫੀ ਨੂੰ ਇੱਕ ਵਧੀਆ ਮੰਨ ਕੇ ਸਾਨੂੰ ਫੋਟੋਗ੍ਰਾਫੀ ਵੀਡੀਓ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਉਹਨਾਂ ਨੂੰ ਦੇਖ ਕੇ ਦੂਸਰੇ ਲੋਕਾਂ ਨੂੰ ਵੀ ਇੱਕ ਵਧੀਆ ਉਤਸ਼ਾਹਿਤ ਜੀਵਨ ਮਿਲ ਸਕੇ ਵੀਡੀਓ ਵਿੱਚ ਸਾਨੂੰ ਵਧੀਆ ਤਰੀਕੇ ਨਾਲ ਕਿਰਦਾਰ ਨਿਭਾਉਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਦੇਖ ਕੇ ਲੋਕ ਆਪਣਾ ਕਿਰਦਾਰ ਵੀ ਉਸ ਸਮੇਂ ਉਸ ਵਿੱਚ ਹੀ ਬਤੀਤ ਕਰਨ ਵਧੀਆ ਤਰੀਕੇ ਨਾਲ ਬਣਾਈਆਂ ਗਈਆਂ ਫੋਟੋਆਂ ਤੁਹਾਡੇ ਲਈ ਇੱਕ ਸੋਰਸ ਦਾ ਵੀ ਸਾਧਨ ਬਣ ਸਕਦੀਆਂ ਹਨ ਤਾਂ ਜੋ ਤੁਸੀਂ ਉਹਨਾਂ ਫੋਟੋਆਂ ਨੂੰ ਖਿੱਚ ਕੇ ਨੈਚੁਰਲ ਫੋਟੋਆਂ ਨੂੰ ਖਿੱਚ ਕੇ ਉਹਨਾਂ ਨੂੰ ਇੰਟਰਨੈਟ 'ਤੇ ਪਾ ਕੇ ਉਹਨਾਂ ਦਾ ਵਧੀਆ ਪੈਸਾ ਕਮਾ ਸਕੋ ਤੁਹਾਡਾ ਇੱਕ ਇਹ ਅਲੱਗ ਤੋਂ ਪੈਸੇ ਦਾ ਸੋਰਸ ਬਣ ਸਕਦਾ ਹੈ ਤਾਂ ਜੋ ਤੁਹਾਨੂੰ ਵਧੀਆ ਇੱਕ ਪੈਸੇ ਦਾ ਸਾਧਨ ਬਣ ਸਕੇ